ਖੇਡਾਂ ਸ ਦੀ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਅਹਿਮ ਭੂਮਿਕਾ ਹੈ ਯਾਨੀ ਕਿ ਮੰਨ ਲਉ ਕਿ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਅੰਗ ਹਨ ਖੇਡ ਦੇ ਨਾਲ ਇੱਕ ਤਾਂ ਸਰੀਰਕ ਮਾਨਸਿਕ ਤੌਰ ਦੇ ਉੱਤੇ ਇਨਸਾਨ ਤੰਦਰੁਸਤ ਰਹਿੰਦਾ ਹੈ ਸਾਡੇ ਪੰਜਾਬ ਦੀਆਂ ਮੁੱਖ ਖੇਡਾਂ ਜਿਵੇਂ ਕਿ ਹਾਕੀ ਕਬੱਡੀ ਭਲਵਾਨੀ ਇਹ ਸਾਡੇ ਪੰਜਾਬ ਦੀਆਂ ਮੁੱਖ ਖੇਡਾਂ ਹਨ ਕਬੱਡੀ ਦੇ ਵਿੱਚ ਵੀ ਸਰੀਰ ਦੀ ਜੋਰ ਅਜਮੈਸ਼ ਹੁੰਦੀ ਹੈ ਮਾਨਸਿਕ ਤੌਰ 'ਤੇ ਤਕੜਾ ਬੰਦਾ ਹੀ ਜਿਹੜਾ ਹੈ ਉਹ ਕਬੱਡੀ ਖੇਡ ਸਕਦਾ ਹੈ ਹਾਕੀ ਦੇ ਵਿੱਚ ਵੀ ਕਾਫੀ ਉੱਚੇ ਪੱਧਰ ਦੇ ਸਾਡੇ ਇੰਡੀਆ ਦੀ ਟੀਮ ਦੇ ਵਿੱਚ ਜ਼ਿਆਦਾਤਰ ਖਿਡਾਰੀ ਸਾਡੇ ਪੰਜਾਬੀ ਹੀ ਹੁੰਦੇ ਹਨ ਇਸ ਦੇ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਬਿਲਕੁਲ ਉਹ ਫਿਟ ਰਹਿੰਦਾ ਹੈ ਮਾਨਸਿਕ ਤੌਰ 'ਤੇ ਬਿਲਕੁਲ ਫਿਟ ਰਹਿੰਦਾ ਹੈ ਨਸ਼ਿਆਂ ਤੋਂ ਬਚਿਆ ਰਹਿੰਦਾ ਹੈ ਜਿਸ ਤਰ੍ਹਾਂ ਪੰਜਾਬ ਦੀ ਨੌਜਵਾਨੀ ਜਿਹੜੀ ਨਸ਼ਿਆਂ 'ਚ ਗਰਕ ਹੋ ਰਹੀ ਆ ਉਹ ਜੇ ਆਪਾਂ ਖੇਡ ਖੇਡਦੇ ਹਾਂ ਤਾਂ ਧਿਆਨ ਉੱਧਰ ਨਹੀਂ ਜਾਂਦਾ ਕਿਉਂਕਿ ਬਿਲਕੁਲ ਉਹ ਮਾਨਸਿਕ ਤੌਰ 'ਤੇ ਇਨਸਾਨ ਫਿੱਟ ਹੁੰਦਾ ਹੈ ਉਹਦੇ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਤਾਂ ਬਿਲਕੁਲ ਉਹ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ